ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵਿਸ਼ਾਲੀ ਸ਼ਰਮਾ ਹੈ ਮੈਂ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਦੀ ਰਹਿਣ ਵਾਲੀ ਹਾਂ ਅੱਜ ਮੈਂ ਤੁਹਾਨੂੰ ਇਹ ਦੱਸਣ ਜਾ ਰਹੀ ਹਾਂ ਕਿ ਕਿਵੇਂ ਟੈਕਨੋਲੋਜੀ ਸਾਡੇ ਸਿੱਖਣ ਅਤੇ ਸਿਖਾਉਣ ਦੇ ਤਰੀਕੇ ਨੂੰ ਕਿਵੇਂ ਬਦਲ ਰਹੀ ਸਕਦੀ ਹੈ ਅਤੇ ਕਿਵੇਂ ਸਾਡਾ ਸਮਾਂ ਬਚਾ ਸਕਦੀ ਹੈ ਅੱਜ ਕੱਲ੍ਹ ਦੇ ਵਿਗਿਆਨਿਕ ਯੁੱਗ ਦੇ ਵਿੱਚ ਟੈਕਨੋਲੋਜੀ ਨੇ ਬਹੁਤ ਹੀ ਜ਼ਿਆਦਾ ਤਰੱਕੀ ਕਰ ਲਈ ਹੈ ਜਿਵੇਂ ਕਿ ਸਿੱਖਿਆ ਵਿੱਚ ਵੀ ਅੱਜ ਕੱਲ੍ਹ ਵਿਗਿਆਨ ਬਹੁਤ ਹੀ ਅੱਗੇ ਵੱਧ ਰਿਹਾ ਹੈ ਅੱਜ ਕੱਲ੍ਹ ਦੇ ਕੋਲਜਿਸ ਸਕੂਲਾਂ ਵਿੱਚ ਟੈਕਨੋਲੋਜੀ ਦੇ ਥਰੂ ਪੜ੍ਹਾਈ ਕਰਵਾਈ ਜਾ ਰਹੀ ਹੈ ਜਿਵੇਂ ਕਿ ਪਹਿਲਾਂ ਟੀਚਰਸ ਸਲੇਟੀਆਂ ਬਲੈਕਬੋਰਡ ਅਤੇ ਵਾਈਟ ਬੋਰਡਾਂ 'ਤੇ ਲਿਖ ਕੇ ਬੱਚਿਆਂ ਨੂੰ ਪੜ੍ਹਾਉਂਦੇ ਸੀ ਪਰ ਅੱਜ ਪਰ ਅੱਜ ਹੁਣ ਤਾਂ ਉਹਨਾਂ ਦੀ ਜਗ੍ਹਾ ਅੱਜ ਕੱਲ੍ਹ ਪ੍ਰੋਜੈਕਟਾਂ ਨੇ ਲੈ ਲਈ ਹੈ ਅਤੇ ਜੋ ਸਾਡੀਆਂ ਕਿਤਾਬਾਂ ਅਤੇ ਪੈਨਸਿਲਾਂ ਪੈੱਨਾਂ ਦੀ ਜਗ੍ਹਾ ਤਾਂ ਲੈਪਟੋਪ ਟੈਬਲੇਟ ਮੋਬਾਇਲ ਫ਼ੋਨ ਨੇ ਲੈ ਲਈ ਨਾਲ਼ ਨਾਲ਼ ਅੱਜ ਕੱਲ੍ਹ ਬੱਚੇ ਤਾਂ ਘਰ ਬੈਠੇ ਬੈਠੇ ਵੀ ਪੜ੍ਹ ਸਕਦੇ ਹਨ ਜੋ ਕਿ ਗੂਗਲ ਮੀਟ ਐਪ ਦੇ ਥਰੂ ਪੜ੍ਹ ਸਕਦੇ ਹਨ ਹੋਰ ਵੀ ਬਹੁਤ ਸਾਰੀਆਂ ਐਪਾਂ ਹਨ ਜਿਨ੍ਹਾਂ 'ਚੋਂ ਬੱਚੇ ਆਓ ਆਪਣੇ ਘਰ ਬੈਠੇ ਸੇਫਲੀ ਪੜ੍ਹ ਸਕਦੇ ਹਨ ਉਹਨਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਹੈ ਹਾਲੇ ਦੇਸ਼ ਹੋਰ ਵੀ ਟੈਕਨੋਲੋਜੀ ਦੀ ਬਹੁਤ ਤਰੱਕੀਆਂ ਹੋ ਰਹੀਆਂ ਹਨ ਧੰਨਵਾਦ